ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸਿਹਤ ਸੰਭਾਲ ਲਈ ਸਭ ਤੋਂ ਵੱਧ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਸਮੇਂ ਸਮੇਂ 'ਤੇ ਬਜ਼ੁਰਗਾਂ ਦਾ ਚੈਕਅਪ ਕੀਤਾ ਜਾਂਦਾ ਫਰੀ ਅੱਖਾਂ ਦਾ ਚੱਕਅਪ ਕੀਤਾ ਜਾਂਦਾ ਅਪਰੇਸ਼ਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਖੂਨ ਚੈੱਕ ਕੀਤਾ ਜਾਂਦਾ ਹੈ ਕੋਈ ਵੀ ਬਿਮਾਰੀ ਹੋਵੇ ਜਾਂ ਕੁਛ ਵੀ ਹੋਵੇ ਪਤਾ ਲੱਗ ਜਾਂਦਾ ਹੈ ਬੱਚਿਆਂ ਦੇ ਲਈ ਉਹਨਾਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਗਰਭਵਤੀ ਇਸਤਰੀਆਂ ਨੇ ਉਹਨਾਂ ਦੇ ਲਈ ਵੀ ਆਸ਼ਾ ਵਰਕਰਸ ਬਹੁਤ ਕੰਮ ਕਰਦੇ ਆ ਅਤੇ ਉਹਨਾਂ ਦੇ ਲਈ ਵੀ ਵੱਖਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਕਿ ਉਹਨਾਂ ਨੂੰ ਮਿਲਦੀਆਂ ਨੇ ਉਸ ਤੋਂ ਬਾਅਦ ਫ਼ਾਜ਼ਿਲਕਾ ਵਿੱਚ ਇੱਕ ਸਿਵਲ ਹੋਸਪਿਟਲ ਆ ਜਿੱਥੇ ਆਪਾਂ ਆਪਣਾ ਇਲਾਜ ਕਰਵਾ ਸਕਦੇ ਹਾਂ ਅਤੇ ਆਪਾਂ ਨੂੰ ਫਰੀ ਦਵਾਈ ਮਿਲਦੀ ਹੈ ਜਿਹੜੀ ਕਿ ਆਪਣੇ ਲਈ ਬਹੁਤ ਫ਼ਾਇਦੇਮੰਦ ਆ ਵਾਲੀ ਗੱਲ ਆ ਕਿ ਕੋਈ ਵੀ ਜਾ ਕੇ ਉੱਥੇ ਦਾ ਇਲਾਜ ਕਰਵਾ ਸਕਦਾ ਹੈ ਕੋਈ ਵੀ ਚੈਕਅਪ ਕਰਵਾ ਸਕਦਾ ਖੂਨ ਟੈਸਟ ਕਰਵਾਉਣਾ ਹੋਵੇ ਜੋ ਵੀ ਕੁਛ ਕਰਵਾਉਣਾ ਹੈ ਆਪਰੇਸ਼ਨ ਵੀ ਉੱਥੇ ਕੀਤੇ ਜਾਂਦੇ ਨੇ ਆਪਣੇ ਉਸ ਤੋਂ ਬਾਅਦ ਉੱਥੇ ਇੱਕ ਸੀ ਟੀ ਸਕੈਨ ਵੀ ਉਪਲਬਧ ਆ ਜਿੱਥੇ ਕਿ ਆਪਾਂ ਆਪਣਾ ਕੋਈ ਵੀ ਸਕੈਨ ਕਰਵਾਉਣਾ ਹੋਵੇ ਕਰਵਾ ਸਕਦੇ ਹਾਂ ਪ੍ਰਾਈਵੇਟ ਹੋਸਪਿਟਲ ਵੀ ਹੈਗੇ ਆ ਜਿਹੜੇ ਕਿ ਆਪਣੇ ਲਈ ਬਹੁਤ ਵਧੀਆ ਕੰਮ ਕਰਦੇ ਆ ਜਿਵੇਂ ਕਿ ਕੋਈ ਹੱਡੀਆਂ ਨਾਲ ਸੰਬੰਧਿਤ ਹੋ ਗਿਆ ਜਾਂ ਮੰਨ ਕੇ ਚੱਲੋ ਆਪਾਂ ਕੋਈ ਸਰਜਰੀ ਕਰਵਾਉਣੀ ਹੈ ਜਾਂ ਕੁਛ ਵੀ ਹੈਗਾ ਵਾ ਪ੍ਰਾਈਵੇਟ ਹੋਸਪਿਟਲਾਂ ਦੀ ਵੀ ਪੂਰੀ ਸੁਵਿਧਾ ਹੈਗੀ ਆ ਸਮੇਂ ਸਮੇਂ 'ਤੇ ਲੋਕਾਂ ਨੂੰ ਬਿਮਾਰੀਆਂ ਨਾਲ ਸੰਬੰਧਿਤ ਅਵੇਅਰ ਵੀ ਕੀਤਾ ਜਾਂਦਾ ਆ ਤਾਂ ਜੋ ਲੋਕ ਆਪਣੇ ਬਿਮਾਰੀਆਂ ਤੋਂ ਬਚਤ ਕਰ ਸਕਣ ਕੋਈ ਮਤਲਬ ਕੀਤਾ ਜਾਂਦਾ ਸਰਵੇ ਕੀਤਾ ਜਾਂਦਾ ਜਾਂ ਫਿਰ ਕੋਈ ਵੀ ਚੈਕਅਪ ਕਰਨਾ ਹੋਵੇ ਤਾਂ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਉਹਨਾਂ ਨੂੰ ਦੱਸਿਆ ਜਾਂਦਾ ਹੈ ਤਾਂ ਸਮੇਂ ਸਮੇਂ 'ਤੇ ਬਹੁਤ ਵਧੀਆ ਸਹੂਲਤਾਂ ਜਿਹੜੀਆਂ ਕਿ ਮਿਲਦੀਆਂ ਰਹਿੰਦੀਆਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸਿਹਤ ਸੰਭਾਲ ਪੱਖੋਂ ਅਤੇ ਇਹ ਬਹੁਤ ਵਧੀਆ ਗੱਲ ਆ